ਆਵਜਾਈ ਦੇ ਬਹੁਤ ਸਾਰੇ ਢੰਗ ਹਨ ਪਰ ਸਭ ਤੋਂ ਪ੍ਰਮੁੱਖ ਸਾਧਨ ਅੱਜ ਦ ਕੱਲ੍ਹ ਜਿਹੜਾ ਹੈ ਉਹ ਬੱਸ ਅਤੇ ਰੇਲਗੱਡੀ ਹੈ ਅਸੀਂ ਯਾਤਰਾ ਲਈ ਰੇਲਗੱਡੀ ਜਾਂ ਬੱਸ ਦਾ ਸਫ਼ਰ ਜ਼ਿਆਦਾ ਜ਼ਿਆਦਾ ਕਰਦੇ ਹਨ ਕਿਉਂਕਿ ਇਹ ਸਾਨੂੰ ਘੱਟ ਰੇਟ ਦੇ ਵਿੱਚ ਵੀ ਪੈਂਦਾ ਹੈ ਮੈਂ ਇੱਕ ਸ ਇੱਕ ਕਿੱਸਾ ਸਾਂਝਾ ਕਰਨਾ ਚਾਹਾਂਗੀ ਜਿਹੜਾ ਕਿ ਮੈਂ ਉਤਰਾਖੰਡ ਜਾ ਰਹੀ ਸੀ ਉਸ ਦੌਰਾਨ ਹੋਇਆ ਇੱਕ ਦਿਨ ਮੈਂ ਰੇਲਗੱਡੀ ਵਿੱਚ ਸਫ਼ਰ ਕਰ ਰਹੀ ਸੀ ਅਤੇ ਮੈਂ ਆਪਣੀ ਸਹੇਲੀਆਂ ਨਾਲ ਸੀ ਉਸ ਦਿਨ ਕਾਫ਼ੀ ਸਾਰੇ ਹਿਲ ਸਟੇਸ਼ਨ ਆਏ ਅਤੇ ਅਸੀਂ ਆਪਸ ਵਿੱਚ ਕਾਫ਼ੀ ਸਾਰੀ ਗੱਲਾਂ ਕਰ ਰਹੇ ਸਨ ਪਰ ਉਸ ਦਿਨ ਮੌਸਮ ਬਹੁਤ ਵਧੀਆ ਸੀ ਅਤੇ ਪਹਾੜਾਂ ਵਿੱਚ ਜਾ ਕੇ ਮੌਸਮ ਹੋਰ ਵੀ ਜ਼ਿਆਦਾ ਵਧੀਆ ਲੱਗਣ ਲੱਗ ਪੈਂਦਾ ਹੈ ਅਤੇ ਉਸ ਦਿਨ ਅਸੀਂ ਕਾਫ਼ੀ ਸਾਰੇ ਗਾਣੇ ਗਾਏ ਅਤੇ ਗੇਮਾਂ ਖੇਡੀਆਂ ਜਿਸਦੇ ਨਾਲ ਮੇਰਾ ਸਫ਼ਰ ਯਾਦਗਾਰ ਬਣਿਆ